ਹੁਣ ਪੰਜਾਬ ਲੋਕ ਆਪਣੀ ਪਹਿਚਾਣ ਅਤੇ ਸੰਬੰਧੀ ਦੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਲਈ ਆਪਣੇ ਵਿਚਾਰ ਇਸ ਤਰ੍ਹਾਂ ਪ੍ਰਗਟ ਕਰਦੇ ਹਨ ਕਿਉਂਕਿ ਪੰਜਾਬੀ ਬਹੁਤ ਹੀ ਪਿਆਰੀ ਬੋਲੀ ਹੈ ਇਹ ਗੁਰੂਆਂ ਦੀ ਬੋਲੀ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਵੀ ਪੰਜਾਬੀ ਵਿੱਚ ਹਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਆਪਣੇ ਸਮੇਂ ਬੱਚਿਆਂ ਨੂੰ ਬਿਠਾ ਕੇ ਪੰਜਾਬੀ ਸਿਖਾਉਂਦੇ ਸਨ ਲੋਕ ਘਰਾਂ ਵਿੱਚ ਹੁਣ ਪੰਜਾਬੀ ਬੋਲਣੀ ਬੰਦ ਕਰ ਦਿੱਤੀ ਹੈ ਹੁਣ ਕਿਉਂਕਿ ਉਹ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਸਿਖਾਉਣਾ ਚਾਹੁੰਦੇ ਹਨ ਅਤੇ ਹਿੰਦੀ ਸਿਖਾਉਂਦੇ ਆ ਪਰ ਹੁਣ ਉਹ ਇਹ ਭੁੱਲ ਗਏ ਹਨ ਕਿ ਇਹ ਸਾਡੀ ਮਾਤ ਬੋਲੀ ਹੈ ਇਸ ਨੂੰ ਕਦੀ ਵੀ ਵਿਸਾਰਨਾ ਨਹੀਂ ਚਾਹੀਦਾ ਇਸ ਕਰਕੇ ਸਾਨੂੰ ਚਾਹੀਦਾ ਹੈ ਕਿ ਅਸੀਂ ਆਪ ਵੀ ਆਪਣੀ ਬੋਲੀ ਨਾਲ ਪਿਆਰ ਕਰੀਏ ਅਤੇ ਆਪਣੇ ਬੱਚਿਆਂ ਨੂੰ ਵੀ ਇਸ ਦੀ ਮਹੱਤਵਤਾ ਬਾਰੇ ਜਾਣੂ ਕਰਵਾਈਏ